ਬਹੁਤ ਪੁਰਾਣੇ ਸਮੇਂ ਤੋਂ ਚੱਲਿਆ ਆ ਰਿਹਾ ਹੈ ਕਿ ਔਰਤਾਂ ਹੀ ਖਾਣਾ ਬਣਾਉਂਦੀਆਂ ਹਨ ਔਰ ਅੱਜ ਦੇ ਸਮੇਂ ਵਿੱਚ ਮਰਦ ਵੀ ਸਾਰਾ ਖਾਣਾ ਬਣਾਉਂਦੇ ਹਨ ਜਦੋਂ ਦੇਖਿਆ ਜਾਵੇ ਸ਼ੈਫਾਂ ਦੇ ਵਿੱਚ ਸਭ ਤੋਂ ਜ਼ਿਆਦਾ ਸ਼ੈਫ ਮਰਦ ਹੀ ਹਨ ਜੋ ਕਿ ਬਹੁਤ ਚੰਗਾ ਖਾਣਾ ਬਣਾਉਂਦੇ ਹਨ ਅਤੇ ਅੱਜ ਵੀ ਘਰ ਦੇ ਵਿੱਚ ਮਰਦ ਵੀ ਖਾਣਾ ਬਣਾਉਂਦੇ ਹਨ ਕਿਉਂਕਿ ਔਰਤਾਂ ਵਰਕਿੰਗ ਵੂਮੈਨ ਵੀ ਹਨ ਜਿਸ ਕਰਕੇ ਮਰਦ ਨੂੰ ਖਾਣਾ ਬਣਾਉਣਾ ਸਿੱਖਣਾ ਚਾਹੀਦਾ ਹੈ ਅਤੇ ਬਣਾਉਣਾ ਚਾਹੀਦਾ ਹੈ ਇਸ ਕਰਕੇ ਜਿਹੜਾ ਵੀ ਹੈ ਉਹ ਮਰਦ ਵੀ ਬਣਾਉਂਦੇ ਹਨ ਅਤੇ ਔਰਤਾਂ ਵੀ ਬਣਾਉਂਦੀਆਂ ਹਨ